ਜਿਸ ਤਰ੍ਹਾਂ ਮੈਂ ਬੀ ਏ ਵਿੱਚ ਪੜ੍ਹ ਰਹੀ ਹਾਂ ਤੇ ਮੈਂ ਬੀ ਏ ਵਿਸ਼ ਬੀ ਏ ਵਿੱਚ ਪੰਜ ਵਿਸ਼ੇ ਮੇਰੇ ਕੋਲ ਹਨ ਇਤਿਹਾਸ ਰਾਜਨੀਤੀ ਸ਼ਾਸ਼ਤਰ ਹਿੰਦ ਹਿੰਦੀ ਅੰਗਰੇਜ਼ੀ ਪੰਜਾਬੀ ਜੇ ਮੈਂ ਗੱਲ ਕਰਾਂ ਇਤਿਹਾਸ ਦੀ ਤਾਂ ਇਸ ਵਿਸ਼ੇ ਨੂੰ ਪੜ੍ਹਕੇ ਮੈਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਸੰਸ਼ਕ੍ਰਿਤੀ ਬਾਰੇ ਬਹੁਤ ਹੀ ਜ਼ਿਆਦਾ ਅ ਜਾਣਕਾਰੀ ਪ੍ਰਾਪਤ ਹੋਈ ਹੈ ਪੁਰਾਣੇ ਸਮੇਂ ਵਿੱਚ ਲੋਕਾਂ ਦੇ ਰਹਿਣ ਦਾ ਢੰਗ ਉਹਨਾਂ ਦੇ ਖਾਣ ਪੀਣ ਉਹਨਾਂ ਦੇ ਬੋਲਣ ਉਹਨੇ ਦੇ ਸੱਭਿਆਚਾਰ ਸੰਸਕ੍ਰਿਤੀ ਕਿਆ ਸੀ ਇਸ ਬਾਰੇ ਬਹੁਤ ਹੀ ਜਾਣ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਰਾਜਨੀਤੀ ਸ਼ਾਸ਼ਤਰ ਵਿਸ਼ੇ ਨੂੰ ਪੜ੍ਹਨ ਨਾਲ ਮੈਨੂੰ ਸਰਕਾਰ ਅਤੇ ਸਰਕਾਰ ਦੀਆਂ ਗਤੀਵਿਧੀਆ ਬਾਰੇ ਬਹੁਤ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਆਪਣੇ ਅਧਿਕਾਰਾ ਅਤੇ ਕਰਤੱਵਾਂ ਪ੍ਰਤੀ ਵੀ ਮੈਨੂੰ ਸੁਚੇਤਤਾ ਆਈ ਹੈ ਅਤੇ ਹਿੰਦੀ ਸਾਹਿਤਕ ਨੂੰ ਪੜ੍ਹਨ ਨਾਲ ਮੈਨੂੰ ਆਪਣੀ ਰਾਸ਼ਟਰੀ ਭਾਸ਼ਾ ਹਿੰਦੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਵਿਸ਼ੇ ਨੂੰ ਪੜ੍ਹਨ ਨਾਲ ਮੇਰੀ ਹਿੰਦੀ ਵਿਆਕਰਨ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ ਅਤੇ ਪੰਜਾਬੀ ਜੋ ਕਿ ਮੇਰੀ ਮਾਂ ਬੋਲੀ ਹੈ ਇਸਨੂੰ ਇਸ ਵਿੱਚ ਸਿੱਖਿਆ ਪ੍ਰਾਪਤ ਕਰਨ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਅਤੇ ਅੰਗਰੇਜ਼ੀ ਜੋ ਕਿ ਇੱਕ ਅੰਤਰਾਸ਼ਟਰੀ ਭਾਸ਼ਾ ਹੈ ਇਸਨੂੰ ਪੜ੍ਹਨ ਨਾਲ ਮੈਨੂੰ ਅੰਗਰੇਜ਼ੀ ਦਾ ਗਿਆਨ ਪ੍ਰਾਪਤ ਹੋਇਆ ਹੈ ਅਤੇ ਅੰਤਰਾਸ਼ਟਰੀ ਪੱਧਰ ਦੇ ਮੁਕਾਬਲੇ ਅਤੇ ਇਮਤਿਹਾਨਾਂ ਨੂੰ ਇਮਤਿਹਾਨਾਂ ਵਿੱਚ ਭਾਗ ਕਰਨ ਨਾਲ ਮੈਨੂੰ ਆਸਾਨੀ ਪ੍ਰਾਪਤ ਹੋਈ ਹੈ ਲਾਸ